ਸਾਡੇ ਪਿੰਡ ਵਿੱਚ ਜਿਹੜੇ ਉਹ ਕਬੱਡੀ ਦੇ ਮੈਚ ਹੁੰਦੇ ਆ ਕਬੱਡੀ ਖੇਡੀ ਜਾਂਦੀ ਆ ਅਤੇ ਮੇਲਿਆਂ ਦੇ ਉੱਪਰ ਕੁਸ਼ਤੀ ਖੇਡੀ ਜਾਂਦੀ ਆ ਅਤੇ ਫੁਟਬਾਲ ਦੇ ਟੂਰਨਾਮੈਂਟ ਵੀ ਕਰਾਏ ਜਾਂਦੇ ਆ ਜਿਹੜੇ ਹਰ ਸਾਲ ਕਰਵਾਏ ਜਾਂਦੇ ਆ ਇਹਨਾਂ ਦੇ ਵਿੱਚ ਲਾਗਲੇ ਚਾਰ ਪੰਜ ਪਿੰਡਾਂ ਤੋਂ ਲੋਕ ਇਕੱਠੇ ਹੋ ਕੇ ਆਉਂਦੇ ਆ ਟੀਮਾਂ ਵੀ ਆਉਂਦੀਆਂ ਖਿਡਾਰੀ ਵੀ ਆਉਂਦੇ ਆ ਅਤੇ ਨਾਲ ਦੀ ਨਾਲ ਦਰਸ਼ਕ ਵੀ ਆਉਂਦੇ ਆ ਦਰਸ਼ਕਾਂ ਦੀ ਗਿਣਤੀ ਜਿਹੜੀ ਉਹ ਪੰਜ ਤੋਂ ਦਸ ਹਜ਼ਾਰ ਤੱਕ ਹੋ ਜਾਂਦੀ ਆ ਜਿਹੜਾ ਬੜਾ ਮਨੋਰੰਜਨ ਕਰਦੇ ਹੁੰਦਾ ਉਹਨਾਂ ਦਾ ਦਰਸ਼ਕਾਂ ਦਾ ਵੀ ਅਤੇ ਜੇ ਗੱਲ ਕੀਤੀ ਜਾਵੇ ਥੋੜ੍ਹੀ ਸਟੇ ਵੱਡੇ ਪੱਧਰ ਦੀ ਤਾਂ ਉਹਦੇ 'ਚ ਕ੍ਰਿਕਟ ਹਾਕੀ ਜਿਹੜੀ ਆ ਉਹ ਖੇਡੀ ਜਾਂਦੀ ਸਾਡੇ ਰਾਜ ਦੇ ਵਿੱਚ ਜਿਹਨਾਂ ਦੇ ਵਿੱਚ ਸਾਡੇ ਜਲੰਧਰ ਵਿੱਚ ਹਾਕੀ ਦੀ ਗਰਾਊਂਡ ਹੈਗੀ ਆ ਤੇ ਮੁਹਾਲੀ ਜਿਹੜਾ ਕ੍ਰਿਕਟ ਦਾ ਸਟੇਡੀਅਮ ਹੈ ਜਿਹਨਾਂ ਦੇ ਵਿੱਚ ਤੀਹ ਹਜ਼ਾਰ ਤੋਂ ਲੈ ਕੇ ਚਾਲੀ ਹਜ਼ਾਰ ਤੱਕ ਜਿਹੜੇ ਲੋਕ ਉਹ ਵੇਖਦੇ ਦਰਸ਼ਕ ਅਤੇ ਸਾਡੇ ਜਿਹੜੇ ਆ ਅੰਮ੍ਰਿਤਸਰ ਦੇ ਵਿੱਚ ਵੀ ਗਰਾਊਂਡ ਹੈਗੀ ਹਾਕੀ ਦੀ ਇੱਥੇ ਵੀ ਬੜਾ ਵਧੀਆ ਖੇਡਾਂ ਦਾ ਪ੍ਰਬੰਧ ਹੁੰਦਾ ਅਤੇ ਜਿਹੜੇ ਖੇਡਾਂ ਦੇ ਵਿੱਚ ਲੋਕ ਭਾਗ ਲੈਂਦੇ ਆ ਉਹਨਾਂ ਦਾ ਮਨੋਰੰਜਨ ਵੀ ਹੁੰਦਾ ਵਾ ਅਤੇ ਨਾਲ ਦੀ ਨਾਲ ਉਹਨਾਂ ਦੇ ਜਿਹੜੇ ਆ ਉਹ ਨਸ਼ਿਆਂ ਤੋਂ ਮੁਕਤ ਹੁੰਦੇ ਲੋਕ ਖਿਡਾਰੀਆਂ ਦਾ ਉਤਸ਼ਾਹ ਵੱਧਦਾ ਵਾ ਹੋਰ ਖੇਡਾਂ ਵਿੱਚ ਨਵੇਂ ਖਿਡਾਰੀ ਵੀ ਪੈਦਾ ਹੁੰਦੇ ਆ